ਪੰਜ ਫਰਵਰੀ ਵੀਹ ਸੌ ਚੌਵੀ ਛੇ ਮਾਰਚ ਵੀਹ ਸੌ ਚੌਵੀ ਅੱਠ ਅਪ੍ਰੈਲ ਵੀਹ ਸੌ ਚੌਵੀ ਨੌ ਮਈ ਵੀਹ ਸੌ ਚੌਵੀ